ਟੀਮ ਲੀਡਰ ਦੇ ਉੱਪਰ ਹੀ ਹੀ ਟੀਮਵਰਕ ਦਾ ਕੰਮ ਹੁੰਦਾ ਹੈ ਟੀਮ ਲੀਡਰ ਨੇ ਹੀ ਟੀਮ ਨੂੰ ਆਪਣੀ ਅਗਲੇ ਮੈਂਬਰਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਕਿ ਕੰਮ ਨੂੰ ਕਿਵੇਂ ਕਰਨਾ ਹੈ ਅਤੇ ਉਸ ਵਿੱਚ ਕੀ ਸੁਧਾਰ ਕਰਨੇ ਹੈ ਜੇਕਰ ਟੀਮ ਦੇ ਮੈਂਬਰ ਸਹੀ ਕੰਮ ਨਹੀਂ ਕਰਦੇ ਤਾਂ ਟੀਮਵਰਕ ਨਹੀਂ ਪੂਰਾ ਹੁੰਦਾ ਇਸ ਲਈ ਟੀਮ ਲੀਡਰ ਨੇ ਕਈ ਸੁਝਾਅ ਦਿੰਦਾ ਹੈ ਆਪਣੀ ਟੀਮ ਨੂੰ ਅਤੇ ਉਹਨਾਂ ਵਿੱਚ ਸੁਧਾਰ ਕਰਨ ਲਈ ਕਹਿੰਦਾ ਹੈ ਤਾਂ ਜੋ ਕਿ ਸਹੀ ਉਸ ਵਰਕ ਦਾ ਡਰਾਇੰਗ ਵਰਕ ਕੀਤਾ ਜਾ ਸਕੇ ਅਤੇ ਆਪਣੇ ਡਰਾਇੰਗ ਪ੍ਰੋਜੈਕਟ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ ਟੀਮ ਲੀਡਰ ਉਹੀ ਹੁੰਦਾ ਹੈ ਜੋ ਆਪਣੇ ਸਹੀ ਵਿਆਖਿਆ ਕਰਦਾ ਹੈ ਅਤੇ ਕੰਮ ਨੂੰ ਸੰਭਾਲਦਾ ਹੈ